ਹੈਲੋ ਹਾਂਜੀ ਸਰ ਤੁਸੀਂ ਫਾਈਨ ਇਲੈਕਟ੍ਰੀਸ਼ਨ ਦੇ ਕੋਲ ਗੱਲ ਕਰ ਰਹੇ ਹੋ ਹਾਂਜੀ ਹਾਂਜੀ ਠੀਕ ਹੈ ਸਰ ਅਤੇ ਵਾਇਰਿੰਗ ਸਰ ਤੁਸੀਂ ਪੂਰੇ ਘਰ ਦੀ ਕਰਵਾਉਣੀ ਹੈ ਜਾਂ ਬਸ ਥੋੜੀ ਬਹੁਤੀ ਹੈ ਜਿਸ ਨੂੰ ਕਰਵਾਉਣੀ ਕੀ ਕਰਨਾ

ਠੀਕ ਹੈ ਸਰ ਠੀਕ ਹੈ ਸਰ ਠੀਕ ਹੈ ਸਰ ਸਰ ਅਸੀਂ ਸਾਡੇ ਕੋਲ ਆਪਸ਼ਨ ਹੁੰਦੀ ਹੈ ਜਿਵੇਂ ਤੁਸੀਂ ਕਹਿ ਰਹੇ ਹੋ ਬੱਚੇ ਨੂੰ ਕਰੰਟ ਨਾ ਲੱਗੇ ਅਤੇ ਜਿੰਨੇ ਵੀ ਸੂਚੀਜ਼ ਬੋਰਡ ਹੁੰਦੇ ਨੇ ਉਹ ਅਸੀਂ ਹਾਈਟ 'ਤੇ ਲਾ ਦਾਂਗੇ ਜਿਵੇਂ ਬੱਚਿਆਂ ਦਾ ਹੱਥ ਹੀ ਨਾ ਜਾਏ ਉਹਦੇ ਕੋਲ ਅਤੇ ਇਹ ਜੀ ਜਗ੍ਹਾ ਲਾਵਾਂਗੇ ਜਿੱਥੇ ਬੱਚਿਆਂ ਨੂੰ ਟੱਚ ਨਾ ਕਰ ਸਕੇ ਅਤੇ ਪ੍ਰੋਪਰ ਉਹਦੇ ਉੱਤੇ ਵੀ ਵਧੀਆ ਸੇਫਟੀ ਬਟਨਸ ਲਾ ਦਾਂਗੇ ਜਿਹਨੂੰ ਬੱਚਾ ਅਸਾਨੀ ਨਾਲ ਟੱਚ ਵੀ ਨਾ ਕਰ ਸਕੇ ਅਤੇ ਤੁਸੀਂ ਸੇਫਟੀ ਅਲਾਰਮ ਦੀ ਗੱਲ ਕੀਤੀ ਸੀ ਅਸੀਂ ਉਹ ਉਹ ਤੁਹਾਡੇ ਕੋਲ ਆਪਸ਼ਨ ਹੈ ਵੀ ਤੁਸੀਂ ਕਿਚਨ ਦੇ ਅੰਦਰ ਹੀ ਪਵਾਉਣਾ ਜਾਂ ਪੂਰੇ ਘਰ ਦੇ ਅੰਦਰ ਹਰ ਇੱਕ ਰੂਮ ਦੇ ਅੰਦਰ ਲਵਾਉਣਾ ਹੈ ਠੀਕ ਹੈ ਸਰ ਉਹ ਵੀ ਸਰ ਤੁਹਾਡੇ ਲੱਗ ਜੇਗਾ ਹਰ ਇੱਕ ਰੂਮ ਦੇ ਅੰਦਰ ਲੱਗ ਜਾਏਗਾ ਪ੍ਰੋਪਰ ਲੱਗ ਜਾਏਗਾ ਅਤੇ ਤੁਸੀਂ ਚਾਹੁੰਦੇ ਹੋ ਫਾ ਫਾਇਰ ਲਾਉਣ ਦੇ ਨਾਲ ਸਾਡੇ ਸਾਡੇ ਕੋਲ ਆਪਸ਼ਨ ਹੈਗੀ ਫਾਇਰ ਲੱਗਦੇ ਅਤੇ ਨਾਲ ਨਾਲ ਵਾਟਰ ਵੀ ਸਪਰਿੰਕਲ ਕਰਦਾ ਉਹ ਤੁਹਾਨੂੰ ਆਪਸ਼ਨ ਚਾਹੀਦੀ ਹੈ ਤਾਂ ਦੇਖ ਲਓ ਨਹੀਂ ਸਰ ਡਿਪੈਂਡ ਕਰਦਾ ਤੁਸੀਂ ਪੂਰੇ ਘਰ ਦਾ ਜਿਵੇਂ ਕਿ ਆਹ ਫਾਇਰ ਅਲਾਰਮ ਚਾਹੀਦਾ ਉਹ ਤੁਹਾਡਾ ਥਾਊਜ਼ੈਂਡ ਦਾ ਆ ਜਾਣਾ ਖਰਚਾ ਅਤੇ ਪਲੱਸ ਜਿਹੜਾ ਵਾਟਰ ਹੈਗਾ ਉਹਦੇ 'ਚ ਪ੍ਰੋਪਰ ਪਾਈਪਿੰਗ ਹੋਏਗੀ ਵਾਟਰ ਦੀ ਉਹਦਾ ਤੁਹਾਡਾ ਤੀਹ ਹਜ਼ਾਰ ਰੁਪਏ ਐਕਸਟਰਾ ਲੱਗ ਜਾਏਗਾ ਪਰ ਸੇਫਟੀ ਪੂਰੀ ਰਹੇਗੀ ਤੁਹਾਡੀ ਹਾਂਜੀ ਸਰ ਹਾਂਜੀ ਸਰ ਅਸੀਂ ਵਧੀਆ ਕੰਮ ਨਹੀਂ ਪ੍ਰੋਪਰ ਤੁਹਾਡੇ ਲਾ ਕੇ ਦੇਵਾਂਗੇ ਪ੍ਰੋਪਰ ਤੁਹਾਨੂੰ ਵਾਇਰਿੰਗ ਅਸੀਂ ਪ੍ਰੋਪਰ ਕਰਕੇ ਦੇਵਾਂਗੇ ਖਰਚੇ ਸ਼ਾਇਦ ਤੁਹਾਡਾ ਜ਼ਿਆਦਾ ਹੋ ਸਕਦਾ ਪਰ ਤੁਹਾਡੀ ਸੇਫਟੀ ਹੰਡਰਡ ਪ੍ਰਸੈਂਟ ਰਹੇਗੀ ਤੁਹਾਨੂੰ ਕੋਈ ਤਾਰ ਸੜਨ ਦਾ ਯਾ ਕੋਈ ਵੀ ਕਿਸੇ ਨੂੰ ਸ਼ੋਕ ਲੱਗਣ ਕੋਈ ਵੀ ਰਿਸਕ ਨਹੀਂ ਰਹਿਣ ਵਾਲਾ ਅਤੇ ਆਰਥਿੰਗ ਪ੍ਰੋਪਰ ਹੋਵੇਗੀ ਵਿਦਾਊਟ ਅਰਥਿੰਗ ਫਿਰ ਤੁਹਾਨੂੰ ਸ਼ੋਕ ਲੱਗਣ ਦਾ ਰਿਸਕ ਰਹਿੰਦਾ ਤੁਹਾਡੇ ਘਰ ਦੇ ਹੋਈ ਹੋਈ ਅਰਥਿੰਗ ਜਦੋਂ ਘਰ ਬਣਵਾਇਆ ਸੀ ਹਾਂਜੀ ਠੀਕ ਹੈ ਸਰ ਮੈਂ ਸਮਝ ਗਿਆ ਉਹ ਤੁਹਾਡੇ ਪ੍ਰੋਪਰ ਅਸੀਂ ਕਰ ਦਾਂਗੇ ਬੋਰਡ ਵਗੈਰਾ ਦੇ ਪ੍ਰੋਪਰ ਅਸੀਂ ਸੇਫਟੀ ਨਾਲ ਹਾਈਟ 'ਤੇ ਲਾ ਦਾਂਗੇ ਅਲਾਰਮ ਵਗੈਰਾ ਲਾ ਦਾਂਗੇ ਨਾਲ ਉਹਦੀ ਵਾਟਰ ਸਿਸਟਮ ਪ੍ਰੋਪਰ ਅਡਜੈਸਟ ਕਰ ਦਾਂਗੇ ਅਤੇ ਤੁਹਾਡਾ ਖਰਚਾ ਫਿਰ ਟੋਟਲ ਫਿਫਟੀ ਟੂ ਸਿਕਸਟੀ ਥਾਊਜੈਂਡ ਆ ਸਕਦਾ ਅਤੇ ਵੇਖ ਲਓ ਸਰ ਠੀਕ ਹੈ ਹਾਂਜੀ ਸਰ ਜੇ ਸਾਡਾ ਸਾਰਾ ਕੰਮ ਸਾਡੇ ਤੋਂ ਕਰਾਓਗੇ ਤੁਹਾਨੂੰ ਫਿਰ ਡਿਸਕਾਊਂਟ ਵੀ ਦੇ ਦਾਂਗੇ ਠੀਕ ਹੈ ਸਰ ਵੇਖੋ ਇਹ ਤਾਂ ਸਰ ਕਾਫੀ ਬਿਜੀ ਕੰਮ ਚੱਲ ਰਿਹਾ ਤੁਹਾਨੂੰ ਅਸੀਂ ਤਿੰਨ ਦਿਨ ਬਾਅਦ ਤੁਹਾਨੂੰ ਕੋਲ ਕਰਾਂਗੇ ਉਸ ਦਿਨ ਤੁਹਾਡੀ ਸ਼ਡਿਊਲਿੰਗ ਹੋ ਜਾਏਗੀ ਠੀਕ ਹੈ ਸਰ ਥੈਂਕ ਯੂ ਫਾਰ ਕੋਲਿੰਗ